ਹਾਂਜੀ ਮੈਂ ਸਕਰੈਚ ਤੋਂ ਇਹ ਡਰਾਇੰਗ ਬਣਾਈ ਹੋਈ ਹੈ ਅਲੱਗ ਅਲੱਗ ਤਰੀ ਤਰ੍ਹਾਂ ਦੀਆਂ ਡਰਾਇੰਗ ਬਣਾਈਆਂ ਹੋਈਆਂ ਨੇ ਬਹੁਤ ਸੋਹਣੀ ਡਰਾਇੰਗ ਬਣਦੀ ਹੈ ਸਕਰੈਚ ਤੋਂ ਅਲੱਗ ਅਲੱਗ ਕਲਰ ਕਲਰਸ ਨਾਲ ਮੈਂ ਅਲੱਗ ਅਲੱਗ ਕਾਰਟ ਕਾਰਟਨਿੰਗ ਕੀਤੀ ਹੋਈ ਹੈ ਅਲੱਗ ਅਲੱਗ ਫਲਾਰਸ ਬਣਾਏ ਹੋਏ ਨੇ ਅਤੇ ਬਹੁਤ ਸੋਹਣੀ ਸੋਹਣੀ ਡਰਾਇੰਗਸ ਬਣਾਈਆਂ ਹੋਈਆਂ ਨੇ ਸਕਰੈਚ ਨਾਲ ਅਤੇ ਇਹ ਇਹ ਦੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਹੈ ਅਤੇ ਸਾਰੇ ਮੇਰੀ ਡਰਾਇੰਗ ਦੀ ਬਹੁਤ ਤਾਰੀਫ ਕਰਦੇ ਹਨ ਅਤੇ ਮੈਂ ਕਲਾ ਅਤੇ ਸ਼ਿਲਪਕਾਰੀ ਦੀ ਮਦਦ ਨਾਲ ਆਪਣੇ ਘਰ ਨੂੰ ਜ਼ਰੂਰ ਸਜਾਉਂਦੀ ਰਹਿੰਦੀ ਹਾਂ ਮੈਂ ਰ ਜੋ ਵੇਸਟ ਮਟੀਰੀਅਲ ਹੁੰਦਾ ਹੈ ਉਹਦੇ ਨਾਲ ਆਪਣੇ ਘਰ ਦੇ ਲਈ ਅਲੱਗ ਅਲੱਗ ਚੀਜ਼ਾਂ ਬਣਾਉਂਦੀ ਰਹਿੰਦੀ ਹਾਂ ਕੁਝ ਨਾ ਕੁਝ ਸਿੱਖ ਸਿੱਖ ਕੇ ਬਣਾ ਕੇ ਆਪਣੇ ਘਰ ਨੂੰ ਸਜਾਉਂਦੀ ਰਹਿੰਦੀ ਹਾਂ ਤਾਂ ਜੋ ਮੇਰਾ ਘਰ ਸੋਹਣਾ ਲ਼ ਲੱਗੇ ਅਤੇ ਮੈਂ ਅਖਬਾਰਾਂ ਨਾਲ ਅਲੱਗ ਅਲੱਗ ਤਰ੍ਹਾਂ ਦੇ ਫੁੱਲ ਫੁੱਲ ਬਣਾਉਂਦੀ ਹਾਂ ਫੋਟੋ ਫਰੇਮ ਬਣਾਉਂਦੀ ਹਾਂ ਅਤੇ ਉਸ ਤੋਂ ਬਾਅਦ ਹੋਰ ਮੈਂ ਪਲਾਸਟਿਕ ਦੇ ਨਾਲ ਪੈਨ ਹੋਲਡਰਸ ਬਣਾਉਂਦੀ ਹਾਂ ਮੇਕਅਪ ਦਾ ਸਮਾਨ ਰੱਖਣ ਲਈ ਬਣਾਉਂਦੀ ਹਾਂ ਪਲਾਸਟਿਕ ਦੇ ਨਾਲ ਬੋਕਸਸ ਅਤੇ ਆਪਣੇ ਗੁਆਂਢੀਆਂ ਨੂੰ ਵੀ ਬਣਾ ਬਣਾ ਕੇ ਦਿੰਦੀ ਹਾਂ